ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਕੱਪੜਾ ਉਦਯੋਗ ਸਾਈਕਲ ਉਦਯੋਗ ਖੇਡਾਂ ਦਾ ਸਮਾਨ ਬਣਾਉਣ ਦੀਆਂ ਫੈਕਟਰੀਆਂ ਅਤੇ ਰੇਲ ਦੇ ਡੱਬੇ ਬਣਾਉਣ ਦਾ ਕਾਰੋਬਾਰ ਵੱਡੇ ਪੈਮਾਨੇ 'ਤੇ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਖੇਤੀਬਾੜੀ ਦਾ ਪ੍ਰਮੁੱਖ ਧੰਦਾ ਹੈ ਪੰਜਾਬ ਦੇ ਬਾਰ੍ਹਾਂ ਹਜ਼ਾਰ ਪੰਜ ਸੌ ਇਕਾਸੀ ਪਿੰਡਾਂ ਵਿੱਚ ਖੇਤੀਬਾੜੀ ਹੁੰਦੀ ਹੈ ਇੱਥੇ ਦੇ ਲੋਕ ਖੇਤੀਬਾੜੀ ਦੇ ਕੰਮ 'ਤੇ ਹੀ ਨਿਰਭਰ ਹਨ ਉਨ੍ਹਾਂ ਦੀ ਆਮਦਨ ਦਾ ਮੁੱਖ ਸਰੋਤ ਖੇਤੀਬਾੜੀ ਅਤੇ ਉਸ ਦੇ ਨਾਲ ਨਾਲ ਅਪਣਾਏ ਹੋਏ ਕਿੱਤੇ ਜਿਵੇਂ ਕਿ ਮੁਰਗੀ ਫਾਰਮ ਅਤੇ ਪਸ਼ੂ ਪਾਲਣ ਮੱਛੀ ਪਾਲਣ ਦਾ ਵੀ ਸਹਾਇਕ ਕੰਮ ਹੁੰਦਾ ਹੈ ਫਸਲ ਦੀ ਖੇਤੀ ਦੇ ਨਾਲ ਨਾਲ ਸਹਾਇਕ ਕੰਮ ਵੀ ਰੋਜ਼ ਦੇ ਕੰਮਾਂ ਦੇ ਵਿੱਚ ਪ੍ਰਮੁੱਖ ਆਮਦਨ ਦਾ ਸਰੋਤ ਹਨ ਡੇਅਰੀ ਫਾਰਮਿੰਗ ਪੰਜਾਬ ਦੇ ਵਿੱਚ ਮੁੱਖ ਤੌਰ 'ਤੇ ਕੀਤਾ ਜਾਂਦਾ ਹੈ ਇਸ ਦੇ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੁੰਦਾ ਹੈ